ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਉਹੀ ਸਰ ਦੇਖੋ ਫੇਮਸ ਜਗ੍ਹਾ ਉਰੇ ਤਾਂ ਵੈਸੇ ਤਾਂ ਪੰਜਾਬ 'ਚ ਫੇਮਸ ਜਗ੍ਹਾ ਤਾਂ ਵੈਸੇ ਵਾਧੂ ਹੈ ਪਰ ਆਪਾਂ ਤੁਹਾਨੂੰ ਇੱਕ ਤਾਂ ਅੰਮ੍ਰਿਤਸਰ ਘੁੰਮਾ ਦਾਂਗੇ ਜੀ ਅਤੇ ਆਪਾਂ ਫੇਮਸ ਫੇਮਸ ਜਗ੍ਹਾ ਉੱਧਰਲੀ ਸਾਈਡ ਆਪਾਂ ਇੱਕ ਤੁਹਾਨੂੰ ਬਾਘਾ ਬੋਡਰ ਸਾਈਡ ਘੁੰਮਾ ਦਾਂਗੇ ਅੰਮ੍ਰਿਤਸਰ ਘੁੰਮਾ ਦਾਂਗੇ ਅਤੇ ਤੁਹਾਨੂੰ ਬਾਕੀ ਹੋਰ ਅਗਰ ਤੁਸੀਂ ਕੋਈ ਤੁਹਾਡਾ ਜਗ੍ਹਾ ਤੁਸੀਂ ਕੋਈ ਦੇਖਣੀ ਚਾਹੁੰਦੇ ਹੋ ਕੋਈ ਤੁਹਾਡਾ ਪਸੰਦੀਦਾ ਜਗ੍ਹਾ ਹੋਵੇ ਪੰਜਾਬ ਦੀ ਉਸ ਸਾਈਡ ਤੁਹਾਨੂੰ ਘੁੰਮਾ ਦਾਂਗੇ ਜੀ ਹਾਂਜੀ ਤੁਹਾਡੇ ਨਾਲ਼ ਸਰ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਨਾਲ਼ ਆਏਗਾ ਅੱਛਾ ਸਰ ਅਤੇ ਜਿੱਦਾਂ ਹੁਣ ਫੈਮਿਲੀ ਮੈਂਬਰ ਤੁਸੀਂ ਸਾਰੇ ਇੰਨੇ ਇੰਨੇ ਜਣੇ ਹੋ ਤੁਸੀਂ ਤਾਂ ਫਿਰ ਟ੍ਰੈਵਲਰ ਗੱਡੀ ਲੈ ਕੇ ਆਊਂਗੇ ਕੋਈ ਗੱਲ ਕੋਈ ਚੱਕਰ ਨਹੀਂ ਹੈ ਸਰ ਤੁਸੀਂ ਇੱਦਾਂ ਕਰਿਓ ਕਿ ਤੁਹਾਨੂੰ ਇੱਕ ਤਾਂ ਆਪਾਂ ਅੰਮ੍ਰਿਤਸਰ ਘੁੰਮਾ ਦਾਂਗੇ ਇੱਕ ਬਾਘਾ ਬਾਡਰ ਘੁੰਮਾ ਦਾਂਗੇ ਇੱਕ ਸਰ ਉੱਥੋਂ ਆਪਾਂ ਇੱਕ ਨਵਾਂ ਸ਼ਹਿਰ ਵਾਲਾ ਗੁਰਦੁਆਰਾ ਸੀਸਗੰਜ ਗੁਰਦੁਆਰਾ ਸਾਹਿਬ ਇੱਧਰਲੀ ਸਾਈਡ ਘੁੰਮਾ ਦਾਂਗੇ ਦਿੱਲੀ ਸਾਈਡ ਤੁਸੀਂ ਆਪਣਾ ਪੰਜਾਬ ਤੋਂ ਬਾਹਰ ਜਾਣ ਲਈ ਇੰਟਰਸਟਿਡ ਹੋ ਤਾਂ ਉੱਧਰਲੀ ਸਾਈਡ ਤੁਹਾਨੂੰ ਲੈ ਚੱਲਾਂਗੇ ਕੋਈ ਦਿੱਕਤ ਨਹੀਂ ਹੈ ਅਤੇ ਸਰ ਜਿਹੜੀ ਪੇਅਮੈਂਟ ਹੈ ਤੁਹਾਨੂੰ ਕਸਟਮਰ ਦੇ ਤੁਸੀਂ ਜਿੱਦਾਂ ਕਿਹਾ ਕਿ ਤੁਸੀਂ ਦਸ ਮੈਂਬਰ ਹੋ ਟੌਟਲ ਤਾਂ ਸਰ ਤੁਹਾਨੂੰ ਇੱਕ ਕਸਟਮਰ ਦਾ ਜਣੀ ਕਿ ਇੱਕ ਮੈਂਬਰ ਦਾ ਪੰਜ ਸੌ ਰੁਪਏ ਦੇ ਹਿਸਾਬ ਦੇ ਨਾਲ਼ ਮੈਨੂੰ ਪੇਅ ਕਰ ਸਕਦੇ ਹੋ ਬਾਕੀ ਕੋਈ ਗੱਲ ਨਹੀਂ ਸਰ ਮੌਕੇ 'ਤੇ ਘੱਟ ਵੱਧ ਕਰ ਲਾਂਗੇ ਕੋਈ ਦਿੱਕਤ ਨਹੀਂ ਹੈ ਵਾਲੀ ਗੱਲ ਨਹੀਂ ਹੈਗੀ ਜੀ ਹਾਂਜੀ ਤੁਸੀਂ ਬਾਕੀ ਆਪਣਾ ਤੁਸੀਂ ਆਪਣਾ ਬਜਟ ਵੀ ਦੱਸਣਾ ਦੱਸ ਸਕਦੇ ਹੋ ਜੀ ਬਿਲਕੁਲ ਹੋ ਸਕਦੀ ਹੈ ਆਪਾਂ ਔਨਲਾਈਨ ਕਰ ਸਕਦੇ ਹੋ ਕੈਸ਼ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਸਰ ਠੀਕ ਲੱਗਦਾ ਉਸ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਸਰ ਚਲੋ ਠੀਕ ਹੈ ਸਰ ਦੱਸ ਠੀਕ ਹੈ ਠੀਕ ਹੈ ਸਰ ਠੀਕ ਹੈ ਓਕੇ